ਸਰਕਾਰ ਵਲੋਂ ਪਿੰਡਾਂ ਦੇ ਵਿੱਚ ਇੰਜੀਨਰਿੰਗ ਦੇ ਜੋ ਕਿ ਪ੍ਰੋਗਰਾਮ ਹਨ ਉਨ੍ਹਾਂ ਦੀ ਜਾਣਕਾਰੀ ਸਾਨੂੰ ਸਾਡੇ ਪਿੰਡ ਦੇ ਵਿੱਚ ਸੁਵਿਧਾ ਸੈਂਟਰ ਬਣੇ ਹੋਏ ਹਨ ਜਿੱਥੇ ਕਿ ਇਹ ਸਾਰੀ ਜਾਣਕਾਰੀ ਮਿਲਦੀ ਹੈ ਅਤੇ ਸਰਕਾਰ ਦੇ ਵਲੋਂ ਪਿੰਡਾਂ ਦੇ ਵਿੱਚ ਮੋਲ ਮੋਡਰਨ ਤਕਨੋਲਜੀ ਦੀ ਵਰਤੋਂ ਕਰਕੇ ਪ੍ਰਯੋਗਸ਼ਾਲਾ ਜਾਂ ਕੰਪਿਊਟਰ ਸੈਂਟਰ ਜਾਂ ਲਾਇਬ੍ਰੇਰੀਆਂ ਵੀ ਬਣਾਈਆਂ ਗਈਆਂ ਹਨ ਜਿੱਥੇ ਕਿ ਸਾਨੂੰ ਇਹਨਾਂ ਤਕਨੋਲਜੀ ਬਾਰੇ ਬਹੁਤ ਨੋਲੇਜ ਮਿਲਦੀ ਹੈ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਵਿੱਚ ਕਈ ਸੰਮੇਲਨ ਕਰਵਾਏ ਜਾਂਦੇ ਹਨ ਜਿਸ ਦੇ ਵਿੱਚ ਮੋਡਰਨ ਟੈਕਨੋਲਜੀ ਬਾਰੇ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਇਸ ਦੀ ਵਰਤੋਂ ਕਰ ਸਕਦੇ ਹਾਂ ਇਹ ਸਾਡੇ ਲਈ ਕਿਸ ਤਰ੍ਹਾਂ ਫਾਇਦੇਮੰਦ ਹਨ ਸੋ ਇਹਨਾਂ ਹੀ ਮੋਡਰਨ ਟੈਕਨੋਲਜੀ ਦੀ ਸਾਰੀਆਂ ਜਿੰਨੀਆਂ ਵੀ ਤਕਨੀਕਾਂ ਹਨ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਹੋਰ ਵੀ ਇਸ ਤੋਂ ਇਲਾਵਾ ਬਹੁਤ ਸਾਰੇ ਸੰਮੇਲਨ ਵੀ ਕਰਵਾਏ ਜਾਂਦੇ ਹਨ ਜਿੱਥੇ ਕਿ ਇਹ ਜਾਣਕਾਰੀ ਆਮ ਜਨਤਾ ਤੱਕ ਸਰਕਾਰ ਵਲੋਂ ਪਹੁੰਚਾਈ ਜਾ ਸਕੇ ਥੈਂਕ ਯੂ ਸੋ ਮੱਚ